ਸਰਦੀਆਂ ਵਿੱਚ ਜਿਵੇਂ ਆਮ ਹੀ ਜ਼ੁਕਾਮ ਹੋ ਜਾਂਦਾ ਹੈ ਅਤੇ ਉਹਦੇ ਬਾਰੇ ਤੁਹਾਨੂੰ ਇਹ ਦੱਸਦੇ ਹਾਂ ਕਿ ਜਿਵੇਂ ਘਰੇਲੂ ਆਪਾਂ ਘਰੇਲੂ ਮਤਲਬ ਕਿ ਇਲਾਜ ਕਰ ਸਕਦੇ ਹਾਂ ਜਿਵੇਂ ਕਿ ਗਰਮ ਪਾਣੀ ਗਰਮ ਪਾਣੀ ਪੀਣਾ ਹੈ ਜਿਵੇਂ ਜਿਸਾ ਜਸੰਦ ਆ ਅਤੇ ਜਾਂ ਫਿਰ ਜਲ ਗਰਮ ਸ਼ਹਿਦ ਤੋਂ ਆਪਾਂ ਅਦਰਕ ਦਾ ਰਸ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਆਪਣਾ ਜ਼ੁਕਾਮ ਠੀਕ ਹੋ ਸਕਦਾ ਹੈ ਹੋਰ ਵੀ ਜਿਵੇਂ ਕਿ ਆਪਾਂ ਕਾੜਾ ਦੋ ਗਿਲਾਸ ਪਾਣੀ ਇੱਕ ਅਦਰਕ ਦਾ ਟੁਕੜਾ ਅਤੇ ਪੰਜ ਦਾਣੇ ਕਾਲੀ ਮਿਰਚ ਜਿਵੇਂ ਕਿ ਆਪਾਂ ਅਜਵੈਣ ਵੀ ਵਿੱਚ ਪਾ ਸਕਦੇ ਹਾਂ ਜੀਰਾ ਵੀ ਪਾ ਸਕਦੇ ਹਾਂ ਸੌਂਫ ਅਤੇ ਮੁਲੱਠੀ ਦਾ ਟੁਕੜਾ ਇਹਦਾ ਉਬਾਲਾ ਆਉਣ ਤੋਂ ਬਾਅਦ ਜਿਵੇਂ ਕਿ ਇਹਨੂੰ ਪੂਰੀ ਤਰ੍ਹਾਂ ਰਿੰਨ ਲੈਣਾ ਹੈ ਇਸ ਤੋਂ ਬਾਅਦ ਕਿ ਆਪਾਂ ਜਿਵੇਂ ਕਿ ਅੱਧਾ ਗਲਾਸ ਰਹਿ ਜਾਣ 'ਤੇ ਹੀ ਆਪਾਂ ਇਹ ਪਾਣੀ ਵਰਤੋਂ ਵਿੱਚ ਲੈ ਸਕਦੇ ਹਾਂ ਅਤੇ ਜਿਵੇਂ ਕਿ ਇਹਦੇ ਨਾਲ ਆਪਣਾ ਜ਼ੁਕਾਮ ਠੀਕ ਹੋ ਸਕਦਾ ਹੈ ਇੱਕ ਆਪਾਂ ਹੋਰ ਵੀ ਇਲਾਜ ਹੈਗਾ ਹੈ ਕਿ ਜਿਵੇਂ ਕਿ ਆਪਾਂ ਮਿੱਠੇ ਚੌਲ ਬਣਾ ਕੇ ਉਹਨਾਂ ਦੀ ਭਾਫ਼ ਵੀ ਲੈ ਸਕਦੇ ਹਾਂ ਉਹਦੇ ਨਾਲ ਵੀ ਜ਼ੁਕਾਮ ਠੀਕ ਹੋ ਜਾਂਦਾ ਹੈ ਅਤੇ ਹੋਰ ਜਿਵੇਂ ਕਿ ਛੋਟੇ ਬੱਚੇ ਨੂੰ ਜ਼ੁਕਾਮ ਹੋਇਆ ਹੁੰਦਾ ਹੈ ਉਹਦੇ ਵਾਸਤੇ ਆਪਾਂ ਇੱਦਾਂ ਦਾ ਕੁਛ ਵੀ ਨਹੀਂ ਕਰਨਾ ਉਹਦੇ ਵਾਸਤੇ ਕੋਈ ਆਪਾਂ ਗਰਮ ਕੱਪੜਾ ਗਰਮ ਕੱਪੜਾ ਤਵੇ 'ਤੇ ਰੱਖ ਕੇ ਉਹਦੇ ਨੱਕ ਨੂੰ ਲਾਉਣਾ ਹੈ ਉਹਦੇ ਨਾਲ ਵੀ ਬੱਚੇ ਦਾ ਜ਼ੁਕਾਮ ਠੀਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਕਿ ਆਪਾਂ ਹੋਰ ਵੀ ਜਿਵੇਂ ਕਿ ਆਪਾਂ ਗਰਮ ਪਾਣੀ ਦੇ ਵਿੱਚ ਇਹ ਮੁਲੱਠੀ ਪਾ ਕੇ ਉਹਦੀ ਭਾਫ਼ ਵੀ ਲੈ ਸਕਦੇ ਹਾਂ